ਅੱਜ ਕੱਲ੍ਹ ਭਾਰਤ ਵਿੱਚ ਟੈਕਨੋਲਜੀ ਨੇ ਬਹੁਤ ਵਿਕਾਸ ਕਰ ਲਿਆ ਹੈ ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਅਸੀਂ ਸਾਨੂੰ ਮਤਲਬ ਕਿਆ ਏ ਅੱਗੇ ਵਧਣ ਦੇ ਲਈ ਜੀਵਨ ਵਿੱਚ ਸੋ ਮਤਲਬ ਅਸੀਂ ਜੇ ਜੀਵਨ ਦੇ ਵਿੱਚ ਸਫਲ ਬਣਨਾ ਹੋਵੇ ਸਫਲ ਬਣਨ ਲਈ ਮਤਲਬ ਕਿਆ ਏ ਅਸੀਂ ਈ ਨਵੀਆਂ ਨਵੀਆਂ ਤਕਨੀਕਾਂ ਦੀ ਲੋੜ ਹੁੰਦੀ ਹੈ ਅਤੇ ਜਿਹੜੀਆਂ ਇਹ ਤਕਨੀਕਾਂ ਇਹ ਸਾਨੂੰ ਅੱਜ ਕੱਲ੍ਹ ਸਮੇਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਟੈਕਨੋਲਜੀ ਹੈ ਇਹ ਸਾਨੂੰ ਜਿਹੜੀਆਂ ਤਕਨੀਕਾਂ ਏ ਇਹ ਮਤਲਬ ਸਾਨੂੰ ਦੇ ਰਹੀ ਹੈ ਐ ਮੌਜੂਦਾ ਸਮੇਂ 'ਚ ਭਾਰਤ ਹਰ ਖੇਤਰ 'ਚ ਟੈਕਨੋਲਜੀ ਅਤੇ ਤਕਨੀਕ ਦੇ ਨਵੇਂ ਮੋੜ ਨੂੰ ਅਪ ਅਪਣਾਉਂਦੇ ਹੋਏ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਮਤਲਬ ਕਿਆ ਏ ਤੇਜ਼ੀ ਨਾਲ ਅੱਗੇ ਵੱਧ ਰਿਹਾ ਏ ਵਧਦੇ ਹੋਏ ਇੱਕ ਏ ਸਾਨੂੰ ਅਜਿਹੀਆਂ ਤਕਨੀਕਾਂ ਦੇ ਰਿਹਾ ਹੈ ਜਿਸ ਦੇ ਨਾਲ ਕਿਆ ਏ ਅਸੀਂ ਨਵੀਂਆਂ ਨਵੀਂਆਂ ਚੀਜ਼ਾਂ ਸਿੱਖ ਸਕਦੇ ਹਾਂ ਜਿਵੇਂ ਕਿ ਡਾਂਸ ਨੂੰ ਹੀ ਲੈ ਲੋ ਡਾਂਸ ਦੇ ਨਾਲ ਅਸੀਂ ਕਿਆ ਏ ਏਹ ਡਾਂਸ ਨਾਲ ਕਿਆ ਏ ਅਸੀਂ ਮਤਲਬ ਅੱਜ ਕੱਲ੍ਹ ਟੈਕਨੋਲਜੀ ਨੇ ਇਨ੍ਹਾਂ ਵਿਕਾਸ ਕਰ ਲਿਆ ਜਿਹਦੇ ਨਾਲ ਸਾਨੂੰ ਕਿਆ ਏ ਡਾਂਸ ਅਸੀਂ ਪਹਿਲਾਂ ਸਾਨੂੰ ਡਾਂਸ ਸਿੱਖਣ ਦੇ ਲਈ ਕਿਤੇ ਜਾਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ ਡਾਂਸ ਸਿੱਖਣ ਦੇ ਲਈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਅਸੀਂ ਕਿਤੇ ਵੀ ਕਿਆ ਏ ਘਰ ਬੈਠ ਕੇ ਅਸੀਂ ਯੂਟੀਊਬ ਦੀ ਹੈਲਪ ਦੇ ਨਾਲ ਇੰਸਟਾਗਰਾਮ ਤੋਂ ਰੀਲਸ ਦੇਖ ਕੇ ਅਸੀਂ ਇਹ ਸਭ ਦੇ ਨਾਲ ਅਸੀਂ ਕਿਆ ਏ ਘਰ ਬੈਠ ਕੇ ਹੀ ਹੀ ਅਸੀਂ ਘਰ ਬੈਠ ਕੇ ਹੀ ਅਸੀਂ ਕਿਆ ਏ ਟੈਕਨੋਲਜੀ ਦਾ ਯੂਸ ਕਰਕੇ ਆਪਾਂ ਘਰ ਹੀ ਡਾਂਸ ਸਿੱਖ ਸਕਦੇ ਹਾਂ ਡਾਂਸ ਸਿੱਖਣ ਦੇ ਨਾਲ ਕਿਆ ਏ ਏ ਆ ਸਾਨੂੰ ਜੋ ਵੀ ਡਾਂਸ ਦੇ ਸਟੈਪ ਹੈ ਉਹ ਸਾਰੇ ਅਸੀਂ ਕਿਆ ਏ ਇਹ ਫੋਨ ਤੋਂ ਹੀ ਮਤਲਬ ਨੈਟਵਰਕ ਨੈਟ ਦਾ ਯੂਸ ਕਰਕੇ ਅਸੀਂ ਇਹ ਕਿਆ ਏ ਏ ਇਹ ਦੀ ਵਰਤੋਂ ਕਰਕੇ ਅਸੀਂ ਕਰ ਸਕਦੇ ਹਾਂ ਅਤੇ ਅੱਜ ਕੱਲ੍ਹ ਮਤਲਬ ਕਿਆ ਏ ਭਾਰਤ ਦੇ ਵਿੱਚ ਹਰ ਖੇਤਰ ਵਿੱਚ ਕਿਆ ਏ ਤਕਨੀਕ ਹੈ ਜੋ ਵੀ ਤਰੱਕ ਤਕਨੀਕ ਨੇ ਮਤਲਬ ਤਕਨੀਕ ਦੀ ਤਰੱਕੀ ਤੋਂ ਬਹੁਤ ਲਾਭ ਉਠਾਇਆ ਹੈ ਅੱਜ ਕਲ੍ਹ ਮਤਲਬ ਕਿਆ ਏ ਜਿੱਦਾਂ ਕਿ ਆਪਾਂ ਫੋਨ ਦੀ ਹੈਲਪ ਦੇ ਨਾਲ ਆਪਾਂ ਡਾਂਸ ਦੇ ਕਿਆ ਏ ਬਹੁਤ ਸਾਰੇ ਸਟੈਪ ਹੈ ਜੋ ਆਪਾਂ ਇਹ ਦੀ ਹੈਲਪ ਦੇ ਨਾਲ ਆਪਾਂ ਦੇਖ ਸਕਦੇ ਹਾਂ